ਪੰਜਾਬ ਵਿੱਚ ਟੈਕਨੋਲੋਜੀ ਸੈਕਟਰ ਦੇ ਉਦਮਤਕ ਅਤੇ ਕਾਰੋਬਾਰੀ ਵਿਕਾਸ ਵਿੱਚ ਕੁਝ ਮੁੱਖ ਤੱਤ ਹਨ ਜੋ ਇਸ ਖੇਤਰ ਵਿੱਚ ਪ੍ਰਫੁੱਲਿਤ ਅਤੇ ਉਤਸ਼ਾਹਤ ਕਰਦੇ ਹਨ ਪ੍ਰਫੁੱਲਿਤ ਗਾਹਕ ਸੇਵਾ ਟੈਕਨੋਲੋਜੀ ਦੀ ਵਰਤੋਂ ਦੇ ਨਾਲ ਕਾਰੋਬਾਰ ਆਪਣਾ ਗਾਹਕਾਂ ਨੂੰ ਜਿਆਦਾ ਤੇਜ਼ ਅਤੇ ਸੁਵਿਧਾ ਜਨਕ ਸੇਵਾ ਪ੍ਰਦਾਨ ਕਰ ਸਕਦੇ ਹਨ ਇਸ ਨਾਲ ਗਾਹਕਾਂ ਦੀ ਸੰਤੁਸ਼ਟੀ ਵੱਧ ਜਾਂਦੀ ਹੈ ਅਤੇ ਉਹਨਾਂ ਨਾਲ ਲੰਬੇ ਸਮੇਂ ਤੱਕ ਵਧੀਆ ਰਿਸ਼ਤੇ ਬਣੇ ਰਹਿੰਦੇ ਹਨ ਸੁਧਾਰੀ ਮਾਰਕੀਟ ਮਾਰਕੀਟਿੰਗ ਮੁਹਿੰਮ ਟੈਕਨਾਲੋਜੀ ਦੀ ਮਦਦ ਦੇ ਨਾਲ ਕਾਰੋਬਾਰ ਆਪਣੇ ਉਤਪਾਦਨਾਂ ਦੇ ਅਤੇ ਸੇਵਾਵਾਂ ਨੂੰ ਨਵੀਨਿਤ ਨਵੀਨ ਮਤ ਢੰਗ ਨਾਲ ਪੇਸ਼ ਕਰਦੇ ਹਨ ਕਰ ਸਕਦੇ ਹਨ ਜੋ ਉਹਨਾਂ ਨੂੰ ਨਵੇਂ ਗਾਹਕ ਤੱਕ ਪਹੁੰਚਾਉਣਾ ਅਤੇ ਮਾਰਕੀਟ ਵਿੱਚ ਆਪਣਾ ਹਿੱਸਾ ਵਧਾਉਣ ਨਾਲ ਮਦਦ ਕਰਦੀ ਹੈ ਐਡਵਾਂਸ ਡਾਟਾ ਆਨ ਆਨ ਲਿਸਟਿਕ ਅਤੇ ਸੋਸ਼ਲ ਮੀਡੀਆ ਟੂਲਸ ਇਸ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ ਪਰਵੇਕ ਅਤੇ ਨਵਾਂ ਕਾਰੋਬਾਰ ਮਾਡਲ ਨਵੀਆਂ ਟੈਕਨੋਲੋਜੀ ਜਿਵੇਂ ਕਿ ਆਰਟੀਫਿਸ਼ਲ ਇੰਟੈਲੀਜੈਂਸ ਬਲਕਿ ਮਸ਼ੀਨ ਲਰਨਿੰਗ ਉਤਪਾਦਕ ਇਸ ਨੂੰ ਇੱਕ ਨਵਾਂ ਰੁਝਾਨ ਦਿੰਦੀ ਹੈ ਇਸ ਦੀ ਵਰਤੋਂ ਦੇ ਨਾਲ ਕਾਰੋਬਾਰ ਆਪਣੇ ਮੌਜੂਦਾ ਮਾਡਲ ਨਾਲ ਨਵੀਆਂ ਦ੍ਰਿਸ਼ਟਾਂ ਦੇਸ਼ਾਂ ਅਤੇ ਉੱਚ ਦਰਜੇ ਦੇ ਕੇ ਦੇ ਸਕਦੇ ਹਨ ਜੋ ਉਹਨਾਂ ਦੀ ਮਾਰਕੀਟ ਵਿੱਚ ਬਿਹਤਰ ਸਥਿਤੀ ਦੇਣ ਵਿੱਚ ਮਦਦ ਕਰਦਾ ਹੈ ਇਸ ਤਰ੍ਹਾਂ ਟੈਕਨਾਲੋਜੀ ਸੈਕਟਰ ਪੰਜਾਬ ਵਿੱਚ ਉਤਪਾਦਕ ਅਤੇ ਕਾਰੋਬਾਰੀ ਵਿਕਾਸ ਨੂੰ ਸਥਿਰ ਨਵੀਨਤਾ ਅਤੇ ਉਤਸ਼ਾਹ ਨਾਲ ਬਹਾਲ ਰੱਖਦੀ ਹੈ